ਸਕੂਲ ਦੇ ਵਿੱਚ ਪੜ੍ਹਨ ਦੌਰਾਨ ਸਾਡੇ ਸਕੂਲ ਦੇ ਵਿੱਚ ਇੱਕ ਅਧਿਆਪਕਾਂ ਨੇ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਹੁੰਦੀ ਸੀਗੀ ਜਿੱਥੇ ਕਿ ਆਪਣੇ ਅਸੀਂ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਵੀ ਇੱਥੋਂ ਕਿਤਾਬਾਂ ਪੜ੍ਹਦੇ ਸੀਗੇ ਜਿਸ ਦੇ ਨਾਲ ਸਾਡਾ ਹੋਰ ਵੀ ਇੰਟਰਸਟ ਬਣਦਾ ਸੀਗਾ ਅਤੇ ਅਧਿਆਪਕ ਵੀ ਸਾਨੂੰ ਜਿਹੜੀਆਂ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕਰਦੇ ਸਨ ਉੱਥੋਂ ਲਾਈ ਹੋਈ ਹੀ ਚੇਟਕ ਇੱਕ ਸਕੂਲ ਦੀ ਲਾਈਬ੍ਰੇਰੀ ਤੋਂ ਲੱਗੀ ਹੋਈ ਚੇਟਕ ਹੀ ਹੁਣ ਸਾਡੇ ਕੰਮ ਆ ਰਹੀ ਹੈ ਕਿਉਂਕਿ ਸਾਡੀ ਪੜ੍ਹਾਈ ਦੇ ਇੰਟਰਸਟ ਜਿਹੜੀਆਂ ਹੁਣ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਇਹ ਸਕੂਲ ਦੀ ਲਾਇਬ੍ਰੇਰੀ ਵਿੱਚ ਹੀ ਪੜ੍ਹੀਆਂ ਕਿਤਾਬਾਂ ਦਾ ਹੈ ਉੱਥੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕਵਿਤਾ ਕਹਾਣੀਆਂ ਚੁਟਕਲਿਆਂ ਦੀਆਂ ਜਿਹੜੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਅੱਜ ਵੀ ਸਾਨੂੰ ਚੇਤੇ ਆ ਅਤੇ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਅਤੇ ਕਵਿਤਾਵਾਂ ਅੱਜ ਵੀ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਸਕੂਨ ਦਿੰਦੀਆਂ ਨੇ ਅਤੇ ਮੈਂ ਮੰਨਦਾ ਹਾਂ ਵੀ ਜਿੱਦਾਂ ਸਕੂਲ ਦੀ ਲਾਇਬ੍ਰੇਰੀ ਵਿੱਚ ਪੜ੍ਹੀਆਂ ਹੋਈਆਂ ਕਿਤਾਬਾਂ ਲੱਗੀ ਹੋਈ ਚੇਟਕ ਜਿਹੜੀ ਅੱਜ ਵੀ ਕੰਮ ਆ ਰਹੀ ਹੈ ਅਤੇ ਹੋਰ ਵੀ ਜਿਹੜੀਆਂ ਅਸੀਂ ਕਿਤਾਬਾਂ ਅਤੇ ਆਪਾਂ ਮੇਰੀ ਪੜ੍ਹਾਈ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਕੰਮ ਆਈਆਂ